ਪਿੰਡ ਵਿੱਚ ਬਹੁਤ ਸਾਰੇ ਬਿਜਨਸ ਹੁੰਦੇ ਹਨ ਪਿੰਡ ਵਿੱਚ ਗ ਕਰਿਆਨੇ ਦਾ ਬਿਜਨਸ ਹੁੰਦਾ ਹੈ ਮੈਡੀਸ ਸਟਾ ਮੈਡੀਕਲ ਸਟੋਰ ਵੀ ਖੁੱਲੇ ਹੁੰਦੇ ਹਨ ਪਿੰਡ ਵਿੱਚ ਹੋਰ ਵੀ ਡੇਅਰੀ ਫਾਰਮ ਦਾ ਬਿਜਨਸ ਹੁੰਦਾ ਹੈ ਪਿੰਡਾਂ ਪਿੰਡ ਦੇ ਵਿੱਚ ਟਿਊਸ਼ਨ ਸੈਂਟਰ ਖੁੱਲੇ ਹੁੰਦੇ ਹਨ ਆਪਣੀ ਰੋਜ਼ੀ ਰੋਟੀ ਲਈ ਸਲਾਈ ਸੈਂਟਰ ਦਾ ਵੀ ਇੱਕ ਬਿਜਨਸ ਹੈ ਸਬਜ਼ੀਆਂ ਦੀ ਖੇਤੀ ਕਰਕੇ ਵੀ ਆਪਾਂ ਬਿਜਨਸ ਸ਼ੁਰੂ ਕਰਦੇ ਹਾਂ ਸਬਜ਼ੀਆਂ ਆਪਾਂ ਵੇਚਦੇ ਹਾਂ ਜਿਸ ਦੇ ਨਾਲ ਇਹ ਵੀ ਬਿਜਨਸ ਦਾ ਵਧੀਆ ਵਪਾਰ ਹੈ ਇਸ ਤੋਂ ਇਲਾਵਾ ਮੁਰਗੀ ਪਾਲਣ ਕਰਕੇ ਉਹਨਾਂ ਦੇ ਆਂਡੇ ਮੀਟ ਵੇਚ ਕੇ ਚੰਗਾ ਲਾਭ ਲੈ ਸਕਦੇ ਹਾਂ ਇਸ ਤਰ੍ਹਾਂ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਪਿੰ ਪਿੰਡ ਵਿੱਚ ਕੰਮ ਸ਼ੁਰੂ ਕਰਕੇ ਚੰਗਾ ਬਿਜਨਸ ਦਾ ਲਾਭ ਉਠਾ ਸਕਦੇ ਹਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਪਿੰਡਾਂ ਵਿੱਚ ਚੰਗੇ ਬਿਜ਼ਨਸ ਚੱਲ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਵੀ ਨਹੀਂ ਹੈ ਇਸ ਕਰਕੇ ਲੋਕ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਹੀ ਪਿੰਡ ਵਿੱਚ ਆਪਣਾ ਬਿਜਨਸ ਚਲਾ ਰਹੇ ਹਨ